ਲੋਕ ਵਿਆਹ ਤੇ ਲਾੜੀ ਨੂੰ ਬਹੁਤ ਸਾਰਾ ਸਮਾਨ ਦਿੰਦੇ ਹਨ ਦਹੇਜ ਵੱਜੋਂ ਜਿਵੇਂ ਕਿ ਗਹਿਣੇ ਅਲਮਾਰੀ ਨੂੰ ਸੋਫਾ ਬਿਸਤਰੇ ਭਾਂਡੇ ਡਰੈਸਿੰਗ ਟੇਬਲ ਪੱਖੇ ਏਸੀ ਜਿਵੇਂ ਅੱਜ ਕੱਲ ਦਾ ਮਤਲਬ ਜਮਾਨਾ ਬਹੁਤ ਤੇਜ਼ ਹੈ ਕਿ ਟੈਕਨੋਲਜੀ ਬਹੁਤ ਸਾਰੀਆਂ ਆ ਗਈਆਂ ਏਸੀ ਵੀ ਚਲਦੇ ਨੇ ਤੇ ਇਦਾਂ ਹੀ ਹੁੰਦੇ ਨੇ ਤੇ ਉਹ ਕਾਰ ਵੀ ਦੇ ਦਿੰਦੇ ਨੇ ਬਹੁਤ ਸਾਰਾ ਦਹੇਜ ਦਾ ਸਾਮਾਨ ਹੈ ਜੋ ਕੁੜੀਆਂ ਨੂੰ ਦਿੱਤਾ ਜਾਂਦਾ ਗਹਿਣੇ ਵੀ ਦਿੱਤੇ ਜਾਂਦੇ ਆ ਹੁ ਰਜਾਈਆਂ ਵੀ ਦਿੱਤੀਆਂ ਜਾਂਦੀਆਂ ਬਿਸਤਰੇ ਵੀ ਦਿੱਤੇ ਜਾਂਦੇ ਆ ਹੋਰ ਵੀ ਜਰੂਰਤ ਮੰਦ ਦਾ ਸਾਰਾ ਸਮਾਨ ਦਿੱਤਾ ਜਾਂਦਾ ਦਹੇਜ ਵਿੱਚ ਬਹੁਤ ਸਾਰਾ ਪਿਆਰ ਵੀ ਦਿੱਤਾ ਜਾਂਦਾ ਸ਼ਗਨ ਵਜੋਂ ਬਹੁਤ ਸਾਰੇ ਪੈਸੇ ਵੀ ਦਿੰਦੇ ਜਾਂਦੇ ਆ ਜਰੂਰਤਮੰਦ ਦਾ ਸਾਰਾ ਸਮਾਨ ਦਿੱਤਾ ਜਾਂਦਾ ਬੈਗ ਕੱਪੜੇ ਲੀੜੇ ਹਰੇਕ ਚੀਜ਼ ਦੋ ਦੋ ਤਿੰਨ ਤਿੰਨ ਸੀ ਸਾਰਾ ਕੁਝ ਦਿੱਤਾ ਜਾਂਦਾ ਰਸੋਈ ਦਾ ਸਾਰਾ ਸਮਾਨ ਹੁੰਦਾ ਡਿਨਰ ਸੈੱਟ ਵੀ ਹੁੰਦੇ ਆ ਕ੍ਰੋਕਰੀ ਵੀ ਦਿੱਤੀ ਜਾਂਦੀ ਆ ਹੋਰ ਬਾਲਟੀਆਂ ਬੁਲਟੀਆਂ ਵੀ ਦੀਤੀਆਂ ਜਾਂਦੀਆਂ ਬਹੁਤ ਸਾਰਾ ਸਮਾਨ ਦਿੱਤਾ ਜਾਂਦਾ ਵੈਸੇ ਕੂਲਰ ਵੀ ਦਿੱਤੇ ਜਾਂਦਾ ਫ੍ਰਿਜ ਵੀ